ਹਾਂਜੀ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਆਪਣੇ ਦਾਦਾ ਜੀ ਤੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਗੱਲਾਂ ਬਾਰੇ ਪਤਾ ਕੀਤਾ ਹੈ ਅਤੇ ਮੇਰੇ ਦਾਦਾ ਜੀ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਸੀ ਉਸ ਵਿੱਚ ਕਿਵੇਂ ਲੋਕਾਂ ਨਾਲ ਹਰ ਪਾਸੇ ਤੋਂ ਵਿਵਹਾਰ ਚੰਗਾ ਕੀਤਾ ਜਾਂਦਾ ਸੀ ਅਤੇ ਕੋਈ ਵੀ ਕੋਈ ਵੀ ਇਨਸਾਨ ਉਸ ਸਮੇਂ ਦੇ ਰਾਜ ਵਿੱਚ ਭੁੱਖਾ ਨਹੀਂ ਰਿਹਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਬਹੁਤ ਸਾਰੀਆਂ ਖੂਬੀਆਂ ਜੋ ਕਿ ਆਪਾਂ ਨੂੰ ਕਿਤਾਬਾਂ ਵਿੱਚੋਂ ਅਤੇ ਨਾਟਕਾਂ ਵਿੱਚੋਂ ਵੀ ਮਿਲ ਜਾਂਦੀਆਂ ਹਨ ਉਹ ਮੈਨੂੰ ਮੇਰੇ ਦਾਦਾ ਜੀ ਨੇ ਦੱਸੀਆਂ ਹਨ